ਭੰਗੜੇ ਦੀ ਮਹੱਤਤਾ ਅਤੇ ਇਸ ਦੀ ਵਿਸ਼ਵ ਵਿਆਪੀ ਪ੍ਰਸਿੱਧੀ ਭੰਗੜਾ ਨਾ ਸਿਰਫ਼ ਪੰਜਾਬ ਦਾ ਬਲਕਿ ਪੂਰੀ ਦੁਨੀਆਂ ਦੀ ਸੱਭਿਆਚਾਰ ਵਿਰਾਸਤ ਦਾ ਇੱਕ ਅਨਮੋਲ ਰਤਨ ਹੈ ਇਸ ਨਾਚ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੈ ਸਗੋਂ ਇਹ ਪੰਜਾਬੀਆਂ ਦੀ ਜੀਵਨ ਸ਼ੈਲੀ ਰੀਤੀ ਰਿਵਾਜ਼ਾਂ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ ਭੰਗੜੇ ਦੀ ਮਹੱਤਤਾ ਨੂੰ ਅਸੀਂ ਇਸ ਤਰ੍ਹਾਂ ਦਰਸਾ ਸਕਦੇ ਹਾਂ ਜਿਵੇਂ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸ਼ਾਹ ਅਤੇ ਜਸ਼ਨ ਦਾ ਪ੍ਰਤੀਕ ਹੈ ਇਹ ਖੇਤਾਂ ਵਿੱਚ ਮਿਹਨਤ ਕਰਨ ਤੋਂ ਬਾਅਦ ਮਿਲੀ ਕਾਮਯਾਬੀ ਦਾ ਜਸ਼ਨ ਮਨਾਉਣ ਦਾ ਇੱਕ ਤਰੀਕਾ ਹੈ ਸੱਭਿਆਚਾਰਕ ਪਛਾਣ ਭੰਗੜਾ ਪੰਜਾਬੀਆਂ ਦੀ ਸੱਭਿਆਚਾਰਕ ਪਛਾਣ ਦਾ ਇੱਕ ਹਿੱਸਾ ਹੈ ਇਹ ਨਾਚ ਪੰਜਾਬੀਆਂ ਦੀ ਜੀਵਨ ਸ਼ੈਲੀ ਰੀਤੀ ਰਿਵਾਜ਼ਾਂ ਅਤੇ ਉਹਨਾਂ ਦੀ ਸੱਭਿਆਚਾਰਕ ਪਹਿਚਾਣ ਦਾ ਕਾਰਣ ਬਣਦਾ ਹੈ ਕਸਰਤ ਅਤੇ ਸਿਹਤ ਭੰਗੜਾ ਇੱਕ ਤੰਦਰੁਸਤੀ ਲਈ ਵੀ ਬਹੁਤ ਵਧੀਆ ਕਸਰਤ ਹੈ ਇਸ ਵਿੱਚ ਸਰੀਰ ਦੇ ਹਰ ਹਿੱਸੇ ਨੂੰ ਹਿਲਾਇਆ ਜਾਂਦਾ ਹੈ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਏਕਤਾ ਅਤੇ ਭਾਈਚਾਰਾ ਭੰਗੜਾ ਇਹ ਲੋਕਾਂ ਨੂੰ ਇਕੱਠਾ ਕਰਨ ਵੇਲੇ ਭਾਈਚਾਰਾ ਬਣਾਉਣ ਦਾ ਇੱਕ ਵਧੀਆ ਸਾਧਨ ਹੈ ਇਸ ਨਾਚ ਲੋਕ ਆਪਸ ਵਿੱਚ ਜੋੜਦਾ ਹੈ ਅਤੇ ਉਹਨਾਂ ਵਿੱਚ ਏਕਤਾ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ ਇਕੱਠੇ ਮਿਲ ਕੇ ਜਸ਼ਨ ਮਨਾਉਂਦੇ ਹਨ ਇਸ ਵਿੱਚ ਕੋਈ ਵੀ ਜਾਤ ਪਾਤ ਧਰਮ ਨਸਲ ਦਾ ਭੇਦ ਭਾਵ ਨਹੀਂ ਕੀਤਾ ਜਾਂਦਾ ਭੰਗੜਾ ਸਾਰੇ ਵਿਸ਼ਵ ਪ੍ਰਸਿੱਧ ਹੋ ਚੁੱਕਿਆ ਹੈ ਭੰਗੜਾ ਹੁਣ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਿਹਾ ਇਹ ਨਾਚ ਦੁਨੀਆ ਭਰ ਵਿੱਚ ਸਿਰਫ਼ ਪੰਜਾਬ ਵਿੱਚ ਹੀ ਨਹੀਂ ਵੱਖ ਵੱਖ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਭੰਗੜਾ ਪਾਇਆ ਜਾਂਦਾ ਹੈ ਭਾਰਤ ਦੇ ਬਾਕੀ ਰਾਜਾਂ ਵਿੱਚ ਵੀ ਭੰਗੜੇ ਦੀ ਬੱਲੇ ਬੱਲੇ ਹੁੰਦੀ ਹੈ ਪੰਜਾਬੀ ਭੰਗੜੇ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਲੈ ਕੇ ਜਾ ਰਹੇ ਹਨ ਵਿਦੇਸ਼ਾਂ ਵਿੱਚ ਵੀ ਭੰਗੜੇ ਦੇ ਗਰੁੱਪ ਹਨ ਜੋ ਇਸ ਨਾਚ ਨੂੰ ਬੜੇ ਸ਼ੌਂਕ ਨਾਲ ਕਰਦੇ ਹਨ ਭਾਰਤੀ ਫਿਲਮਾਂ ਵਿੱਚ ਭੰਗੜੇ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਭੰਗੜਾ ਨਾ ਸਿਰਫ਼ ਇੱਕ ਨਾਚ ਹੈ ਸਗੋਂ ਇਹ ਪੰਜਾਬੀਆਂ ਦੀ ਜੀਵਨ ਸ਼ੈਲੀ ਅਤੇ ਰੀਤੀ ਰਿਵਾਜ਼ ਸੱਭਿਆਚਾਰ ਦਾ ਇਕ ਅਨਮੋਲ ਰਤਨ ਹੈ